ਦੱਸਿਆ ਜਾਵੇ ਤਾਂ ਮੈਂ ਬਹੁਤ ਜ਼ਿਆਦਾ ਸਾਰੇ ਸਿੰਗਰਾਂ ਨੂੰ ਜਿਹੜਾ ਕਿ ਲਾਈਵ ਸੁਣਿਆ ਆ ਪਰ ਰਣਜੀਤ ਬਾਵਾ ਦਾ ਜਿਹੜਾ ਮੈਂ ਉਹਨਾਂ ਦੀ ਲਾਈਵ ਸੰਗੀਤ ਦਾ ਜਿਹੜਾ ਅਨੁਭਵ ਦੱਸਣ ਜਾ ਰਹੀ ਹਾਂ ਜਿੱਦਾਂ ਕਿ ਉਹ ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਵਧੀਆ ਹੈ ਜਿੱਦਾਂ ਉਹ ਫ ਸੌਂਗ ਗਾਉਂਦੇ ਨੇ ਟੀ ਟੀ ਵੀ 'ਚ ਦੇਖਦੇ ਹਾਂ ਆਪਾਂ ਮੋਬਾਇਲ ਫ਼ੋਨ 'ਚ ਸੁਣਦੇ ਹਾਂ ਉੱਦਾਂ ਹੀ ਉਹਨਾਂ ਦੀ ਰੀਅਲ 'ਚ ਆਵਾਜ਼ ਹੈ ਅਤੇ ਉਹ ਦੁਨੀਆਂ ਦੀ ਮਤਲਬ ਕਿ ਸਾਰੀ ਸੱਚੀਆਂ ਗੱਲਾਂ ਰੀਅਲ ਲਾਈਫ ਬਾਰੇ ਗਾਉਂਦੇ ਨੇ ਅਤੇ ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਵਧੀਆ ਏ ਅਤੇ ਉਹ ਮਤਲਬ ਸਾਰਿਆਂ ਨਾਲ ਨੈਚੁਰਲੀ ਲੈਂਦੇ ਨੇ ਅਤੇ ਜੇਕਰ ਉਹਨਾਂ ਨਾਲ ਪਿਕਚਰ ਕਲਿੱਕ ਕਰਵਾਉਣ ਜਾਂਦਾ ਆ ਕੋਈ ਉਹਨਾਂ ਦਾ ਫੈਨ ਅਤੇ ਉਹ ਬਹੁਤ ਜ਼ਿਆਦਾ ਤਰੀਕੇ ਵਧੀਆ ਤਰੀਕੇ ਨਾਲ ਨਾਲ ਪੇਸ਼ ਵੀ ਆਉਂਦੇ ਨੇ ਅਤੇ ਉਹਨਾਂ ਦਾ ਸੁਭਾਅ ਵੀ ਬਹੁਤ ਅੱਛਾ ਆ ਅਤੇ ਗੱਲ ਕਰੀਏ ਜੇ ਜੇ ਕਿ ਮੈਂ ਕਿਹੜੇ ਗਾਇਕ ਨੂੰ ਸੁਣਨਾ ਚਾਹੁੰਦੀ ਹਾਂ ਤਾਂ ਉਹ ਨਿਮਰਤ ਖਾਇਰਾ ਜੀ ਨੇ ਬਿਕੋਜ਼ ਉਹਨਾਂ ਦਾ ਮੈਨੂੰ ਜਿਹੜਾ ਕਿ ਗਾਉਣ ਦਾ ਢੰਗ ਬਹੁਤ ਵਧੀਆ ਲੱਗਦਾ ਆ ਅਤੇ ਉਹਨਾਂ ਦੀ ਆਵਾਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਉੱਦਾਂ ਵੀ ਉਹ ਬਹੁਤ ਸੋਹਣੇ ਨੇ ਅਤੇ ਉਹਨਾਂ ਦੀ ਡਰੈਸਿੰਗ ਸੈਂਸ ਵੀ ਬਹੁਤ ਅੱਛੀ ਹੈ ਤਾਂ ਕਰਕੇ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਸੁਣਨਾ ਜਿਹੜਾ ਕਿ ਮੇਰੀ ਇੱਛਾ ਆ ਅੰਦਰੋਂ ਕਿ ਮੈਂ ਉਹਨਾਂ ਨੂੰ ਸੁਣਾ ਅਤੇ ਇਹ ਮੇਰੀ ਇੱਛਾ ਜਦ ਤੱਕ ਨਹੀਂ ਖਤਮ ਹੋ ਸਕਦੀ ਜਦੋਂ ਤੱਕ ਮੈਂ ਉਹਨਾਂ ਨੂੰ ਸੁਣ ਨਹੀਂ ਲੈਂਦੀ ਅਤੇ ਉਹਨਾਂ ਦੀ ਗਾਇਕੀ ਜਿਹੜੀ ਕਿ ਬਹੁਤ ਵਧੀਆ ਆ ਅਤੇ ਉਹ ਵਧੀਆ ਬਹੁਤ ਜ਼ਿਆਦਾ ਗਾਣੇ ਗਾਉਂਦੇ ਨੇ ਅਤੇ ਉਹ ਬਹੁਤ ਜ਼ਿਆਦਾ ਮਤਲਬ ਕਿ ਵਧੀਆ ਸਿੰਗਰ ਨੇ ਇੰਡਸਟਰੀ ਦੇ ਪੰਜਾਬ ਇ ਜਿਹੜੀ ਪੰਜਾਬੀ ਹੈਗੀ ਹੈ ਸਾਰੀ ਇੰਡਸਟਰੀ ਉਹਨਾਂ ਤੋਂ ਉਹ ਵਧੀਆ ਮਤਲਬ ਕਿ ਗਾਉਂਦੇ ਨੇ ਸਾਰਿਆਂ ਨਾਲੋਂ ਮੈਨੂੰ ਚੰਗੇ ਲੱਗਦੇ ਨੇ